ਵਾਤਾਵਰਨ ਬਹੁਤ ਜ਼ਿਆਦਾ ਜਰੂਰੀ ਆ ਸੰਭਾਲਣਾ ਖਾਸ ਤੌਰ 'ਤੇ ਸਾਨੂੰ ਪਲਾਸਟਿਕ ਦੀ ਇਸਤੇਮਾਲ ਬਿਲਕੁਲ ਨਹੀਂ ਕਰਨਾ ਚਾਹੀਦਾ ਔਰ ਖਾਸ ਤੌਰ 'ਤੇ ਜਦੋਂ ਅਸੀਂ ਕਿਤੇ ਘੁੰਮਣ ਜਾਂਦੇ ਹਾਂ ਤਾਂ ਸਾਨੂੰ ਵੇਸਟ ਜੋ ਅਸੀਂ ਕਚਰਾ ਇਕੱਠਾ ਕਰ ਰਹੇ ਹਾਂ ਕੂੜਾ ਜਿਹਨੂੰ ਕਹਿੰਦੇ ਹਾਂ ਉਹਨੂੰ ਸੰਭਾਲਣਾ ਚਾਹੀਦਾ ਇੱਕ ਜਗ੍ਹਾ ਜਿੱਥੇ ਪੁਆਇੰਟ ਬਣਿਆ ਹੋਇਆ ਹੈ ਜਿੱਥੇ ਡ ਰੱਖਣ ਲਈ ਗੇਰਨ ਲਈ ਸਥਾਨ ਬਣਾਇਆ ਉਹਨੂੰ ਉੱਥੇ ਗੇਰੀਏ ਪਹਾੜਾਂ ਦੀ ਗੱਲ ਕਰਾਂ ਤਾਂ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਕਚਰਾ ਫੈਲਾਤਾ ਆਮ ਤੌਰ 'ਤੇ ਤੁਹਾਨੂੰ ਪਲਾਸਟਿਕ ਗਿਰੀ ਹੋਈ ਮਿਲ ਜਾਏਗੀ ਗੰਦ ਪਾਇਆ ਹੋਇਆ ਮਿਲ ਜਾਏਗਾ ਜੋ ਕਿ ਨਾ ਤਾਂ ਪਹਾੜਾਂ ਵਾਸਤੇ ਚੰਗਾ ਹੈ ਅਤੇ ਨਾ ਹੀ ਸਾਡੇ ਲਈ ਚੰਗਾ ਹੈ ਕਿਉਂਕਿ ਪਹਾੜਾਂ ਦੇ ਵਿੱਚੋਂ ਨਦੀਆਂ ਪਾਣੀਆਂ ਇਕੱਠੇ ਹੋ ਕੇ ਨੀਚੇ ਜਮੀਨ 'ਤੇ ਪਹੁੰਚਦਾ ਹੈ ਜਿਹੜਾ ਕਿ ਸਾਡੇ ਕੋਲ ਵੀ ਗੰਦਾ ਹੋ ਕੇ ਪਾਣੀ ਉਹੀ ਸਾਡੀ ਗੰਦਗੀ ਤੋਂ ਫੈਲਾਇਆ ਵਾ ਆ ਰਿਹਾ ਜੋ ਕਿ ਬਹੁਤ ਜ਼ਿਆਦਾ ਗਲਤ ਹੈ